ਪੰਜਾਬੀ ਭਾਸ਼ਾ ਦੁਨੀਆ ਦੀਆਂ ਵਿਲੱਖਣ ਭਾਸ਼ਾਵਾਂ ਵਿੱਚ ਇੱਕ ਹੈ ਪੰਜਾਬੀ ਭਾਸ਼ਾ ਵਿੱਚ ਦੁਨੀਆ ਦੀ ਕੋਈ ਵੀ ਭਾਸ਼ਾ ਨੂੰ ਬੋਲਣ ਦੀ ਲਿਖਣ ਦੀ ਅਜ਼ਾਦੀ ਹੈ ਪੰਜਾਬੀ ਭਾਸ਼ਾ ਵਿੱਚ ਅਜਿਹੀਆਂ ਧੁਨੀਆਂ ਹਨ ਜਿਸ ਨਾਲ ਦੁਨੀਆ ਦੀ ਕਿਸੀ ਵੀ ਭਾਸ਼ਾ ਦਾ ਉਚਾਰਨ ਲਿਖਿਆ ਜਾ ਸਕਦਾ ਹੈ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਹਰ ਤਰ੍ਹਾਂ ਦੀ ਸੁਵਿਧਾ ਮੌਜੂਦ ਹੈ ਪੰਜਾਬੀ ਭਾਸ਼ਾ ਗੋਲ ਅੱਖਰਾਂ ਨਾਲ ਚੌਰਸ ਅੱਖਰਾਂ ਨਾਲ ਤਿਕੋਣੇ ਅੱਖਰਾਂ ਨਾਲ ਵੀ ਪੰਜਾਬੀ ਭਾਸ਼ਾ ਬਣਦੀ ਹੈ ਪੰਜਾਬੀ ਭਾਸ਼ਾ ਨੂੰ ਇਹ ਮੰਨਿਆ ਜਾਂਦਾ ਹੈ ਕਿ ਬ੍ਰਾਹਮੀ ਲਿਪੀ ਵਿੱਚੋਂ ਨਿਕਲੀ ਹੈ ਪਰ ਪੰਜਾਬੀ ਭਾਸ਼ਾ ਦੇ ਅਠਾਰਾਂ ਅੱਖਰ ਲਿ ਫੋਨੀਸ਼ੀਆਈ ਲਿਪੀ ਦੇ ਬਣੇ ਹੋਏ ਲੱਗਦੇ ਹਨ ਸੋ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਜਿਹੜੀ ਲਿਪੀ ਵਰਤੀ ਜਾਂਦੀ ਹੈ ਇਹਦੇ ਬਾਰੇ ਹਾਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਕਲੀਅਰੈਂਸ ਸਾਨੂੰ ਨਹੀਂ ਮਿਲਦੀ ਸੋ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਭਾਸ਼ਾ ਭਾਵੇਂ ਕਿ ਦੁਨੀਆ ਦੀਆਂ ਬਾਕੀ ਭਾਸ਼ਾਵਾਂ ਵਾਂਗ ਹੀ ਹੈ ਪਰ ਇਸ ਦੀ ਵਿਲੱਖਣਤਾ ਬਾਕੀ ਭਾਸ਼ਾਵਾਂ ਤੋਂ ਅੱਡਰੀ ਹੈ